ਤੁਹਾਡੇ ਇਲਾਕੇ ਦੇ ਵਿੱਚ ਵੀ ਕੁਛ ਵਹਿਮ ਭਰਮ ਪ੍ਰਚਲਿਤ ਹਨ ਜਿਹਨਾਂ ਦੇ ਉੱਤੇ ਕਿ ਲੋਕ ਆਮ ਤੌਰ 'ਤੇ ਵਿਸ਼ਵਾਸ ਕਰਦੇ ਹਨ ਜਿਹੜਾ ਛਿੱਕ ਮਾਰਨ ਦਾ ਕੰਮ ਹੈ ਉਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਕਹਿੰਦੇ ਨੇ ਕਿ ਅਗਰ ਕਿਸੇ ਨੇ ਕੋਈ ਕੰਮ 'ਤੇ ਜਾਣਾ ਹੋਵੇ ਅਤੇ ਛਿੱਕ ਵੱਜ ਜਾਵੇ ਤਾਂ ਉਹ ਕੰਮ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਰਾਤ ਨੂੰ ਝਾੜੂ ਨਹੀਂ ਫੇਰਿਆ ਜਾਂਦਾ ਕਹਿੰਦੇ ਵੀ ਇਸ ਨੂੰ ਵੀ ਅਸ਼ੁਭ ਮੰਨਿਆ ਗਿਆ ਹੈ ਨਹਿਰਾਂ ਦੇ ਵਿੱਚ ਜਿਹੜਾ ਸਮਾਨ ਆਪਾਂ ਸੁੱਟਦੇ ਹਾਂ ਅਤੇ ਉਸ ਨਾਲ ਕਹਿੰਦੇ ਗ੍ਰਹਿਾਂ ਦਾ ਸਮਾਧਾਨ ਹੁੰਦਾ ਸ਼ਰਾਦ ਕਰਨ ਦਾ ਵਹਿਮ ਅੱਜ ਵੀ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਹੈ ਜਦ ਕਿ ਸ਼ਰਾਧ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਝਾੜੂ ਨੂੰ ਘਰ ਦੇ ਵਿੱਚ ਖੜਾ ਨਹੀਂ ਕੀਤਾ ਜਾਂਦਾ ਕਹਿੰਦੇ ਕਿ ਇਹਦੇ ਨਾਲ ਮੁਸੀਬਤ ਆ ਜਾਂਦੀ ਹੈ ਔਰ ਅਗਰ ਬਿੱਲੀ ਰਾਹ ਕੱਟ ਜਾਵੇ ਤਾਂ ਇਸ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ ਅਤੇ ਕਹਿੰਦੇ ਜੀ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਇਹ ਵਹਿਮ ਭਰਮ ਲੋਕਾਂ ਦੇ ਵਿੱਚ ਆਮ ਤੌਰ 'ਤੇ ਬਹੁਤ ਜ਼ਿਆਦਾ ਫੈਲੇ ਹੋਏ ਹਨ ਔਰ ਪੜ੍ਹੇ ਲਿਖੇ ਲੋਕ ਇਸ ਨੂੰ ਬਹੁਤ ਜ਼ਿਆਦਾ ਮੰਨਦੇ ਹਨ ਅਸੀਂ ਲੋਕ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰ ਰਹੇ ਹਾਂ